ਪੰਜਾਬ ਵਿੱਚ ਕੁੜੀਆਂ ਅਤੇ ਮੁੰਡਿਆਂ ਦੀਆਂ ਕਈ ਅਜਿਹੀਆਂ ਖੇਡਾਂ ਹਨ ਜੋ ਤਾਂ ਕਈ ਸਾਂਝੀਆਂ ਹਨ ਅਤੇ ਕੁਝ ਅਲੱਗ ਕੱਲੇ ਕੱਲੇ ਇਹਨਾਂ ਦੀਆਂ ਜੋ ਕੁੜੀਆਂ ਨਾਲ ਸੰਬੰਧ ਰੱਖਦੇ ਨੇ ਖੇਲੀ ਕੁਝ ਮੁੰਡਿਆਂ ਦੇ ਨਾਲ ਹੀ ਸੰਬੰਧ ਰੱਖਦੇ ਨੇ ਜੋ ਖੇਡਿਆਂ ਜਾਂਦੀਆਂ ਹਨ ਜਿਵੇਂ ਆਪਾ ਕੁੜੀਆਂ ਦੇ ਦੇਖਿਆ ਜਾਵੇ ਤਾਂ ਇਹਨਾਂ ਵਿੱਚ ਇੱਕ ਪੀਚੋ ਹੈ ਜਿਸ ਵਿੱਚ ਇਹ ਇੱਕ ਚਾਰ ਖਾਨਾ ਬਣਾ ਕੇ ਚਾਰ ਖਾਨੇ ਬਣਾ ਲੈਂਦੀਆਂ ਹਨ ਅਤੇ ਉਸ ਵਿੱਚ ਇੱਕ ਗੀਟਾ ਲੈ ਕੇ ਉਸ ਨਾਲ ਖੇਲਦੀਆਂ ਹਨ ਅਤੇ ਕੁਝ ਦੂਜੀ ਖੇਡ ਜੇ ਦੇਖੀ ਜਾਵੇ ਤਾਂ ਉਸ ਵਿੱਚ ਇੱਕ ਇਹਨਾਂ ਕੋਲ ਗੀਟੇ ਹੁੰਦੇ ਹਨ ਜੋ ਕੇ ਪੱਥਰ ਦੇ ਛੋਟੇ ਛੋਟੇ ਟੁੱਕੜੇ ਹੁੰਦੇ ਹਨ ਅਤੇ ਉਸਨੂੰ ਹੱਥ ਨਾਲ ਖੇਲਦੀਆਂ ਹਨ ਅਤੇ ਇੱਕ ਇਹਨਾਂ ਦੀ ਖੇਡ ਹੁੰਦੀ ਹੈ ਥਾਲ ਜੋ ਕਿ ਇਹਨਾਂ ਨੂੰ ਖੇਲੀ ਜਾਂਦੀ ਹੈ ਅਤੇ ਮੁੰਡਿਆਂ ਦੀਆਂ ਖੇਡਾ ਵਿੱਚ ਜੇ ਆਪਾਂ ਦੇਖਿਆ ਜਾਵੇ ਤਾਂ ਇਨ੍ਹਾਂ ਵੱਲੋਂ ਇੱਕ ਪਿੱਠੂ ਹੁੰਦਾ ਹੈ ਜਿਸ ਵਿੱਚ ਇਹ ਗੀਟਿਆਂ ਨੂੰ ਇੱਕ ਜਗ੍ਹਾਂ 'ਤੇ ਇਕੱਠੇ ਕਰ ਲੈਂਦੇ ਹਨ ਅਤੇ ਉਸਨੂੰ ਬੋਲ ਨਾਲ ਤੋੜਕੇ ਫਿਰ ਉਸ ਨਾਲ ਮੁੰਡੇ ਦੇ ਜੋ ਗੀਟਾ ਫੜ੍ਹ ਲੈਦਾ ਹੈ ਉਸਨੂੰ ਉਹਦੇ ਮਗਰ ਭੱਜਦੇ ਹਨ ਅਤੇ ਇਸ ਵਿੱਚ ਦੂਜੀ ਖੇਡ ਹੈ ਇਹਨਾਂ ਦੀ ਗੁੱਲੀ ਡੰਡਾ ਜਿਸਨੂੰ ਇਹ ਇੱਕ ਗੁੱਲੀ ਲੈ ਲੈਂਦੇ ਹੈ ਅਤੇ ਇੱਕ ਡੰਡਾ ਲੈ ਲੈਂਦੇ ਹੈ ਅਤੇ ਡੰਡੇ ਨਾਲ ਗੁੱਲੀ ਨੂੰ ਜਿੰਨੀ ਦੂਰ ਹੁੰਦੇ ਆ ਉਸਨੂੰ ਮਾਰਦੇ ਹਨ ਅਤੇ ਤੀਜੀ ਖੇਡ ਇਹਨਾਂ ਨੂੰ ਬਾਂਦਰ ਗਿੱਲਾਂ ਖੇਲੀ ਜਾਂਦੀ ਹੈ ਅਤੇ ਇੱਕ ਜੇ ਇਹਨਾਂ ਦੀ ਸਾਂਝਿਆ ਖੇਡਾਂ ਦੀ ਗੱਲ ਕਰੀ ਜਾਈਏ ਤਾਂ ਇਹਨਾਂ ਬਾਰੇ ਇੱਕ ਛਿਪਾਕੀ ਖੇਡ ਹੈ ਜੋ ਕਿ ਇਹ ਸਾਂਝੀ ਖੇਡੀ ਜਾਂਦੀ ਹੈ ਅਤੇ ਇੱਕ ਛੂਹਣ ਛਣੀਕਾ ਖੇਡ ਹੈ ਜੋ ਕਿ ਇਹਨਾਂ ਇਹ ਵੀ ਇਹਨਾਂ ਵੱਲੋਂ ਸਾਂਝੀ ਖੇਡੀ ਜਾਂਦੀ ਹੈ ਅਤੇ ਕਬੱਡੀ ਖੇਡ ਹੈ ਇੱਕ ਜੋ ਇਹ ਵੀ ਇਹਨਾਂ ਵੱਲੋਂ ਮੁੰਡਿਆਂ ਵੱਲੋਂ ਵੀ ਖੇਡੀ ਜਾਂਦੀ ਹੈ ਅਤੇ ਕੁੜੀਆਂ ਵੱਲੋ ਵੀ ਖੇਡੀ ਜਾਂਦੀ ਹੈ ਅਤੇ ਹੋਰ ਵੀ ਕਈ ਜੋ ਖੇਡਾਂ ਹਨ ਜੋ ਇਹਨਾਂ ਕੋਲ ਸਾਂਝੀਆਂ ਖੇਲੀਆਂ ਜਾ ਸਕਦੀਆਂ ਹਨ